ਹੈਲੋ ਅੱਛਾ ਰਾਮ ਰਾਮ ਜੀ ਹਾਂਜੀ ਹਾਂਜੀ ਹਾਂਜੀ ਉਹ ਹੀ ਬੋਲਦੇ ਹਾਂ ਜੀ

ਹਾਂਜੀ ਹਾਂਜੀ ਅੱਛਾ ਜੀ ਹਾਂਜੀ ਬਾਕਸ ਵਾਲੇ ਬੈਡ ਹਾਂਜੀ

ਨਹੀਂ ਆਪਣੇ ਕੋਲ ਜੇ ਤੁਸੀਂ ਮਤਲਬ ਬਣਵਾਉਣਾ ਤਾਂ ਵਧੀਆ ਬਣਾ ਕੇ ਦੇਵਾਂਗੇ ਅਤੇ ਤਿਆਰ ਕਰ ਦਿਆਂਗੇ

ਹਾਂਜੀ ਕਿਉਂਕਿ ਆਪਾਂ ਤਾਂ ਜਿਨ੍ਹਾਂ ਦੇ ਵੀ ਬਣਾਏ ਆ ਵਧੀਆ ਹੀ ਬਣਾਏ ਆ ਅਤੇ ਕੋਈ ਅੱਜ ਤੱਕ ਸ਼ਿਕਾਇਤ ਨਹੀਂ ਆਈ ਅਤੇ ਜਿੱਦਾਂ ਦਾ ਅਗਲਾ ਨਕਸ਼ਾ ਦਿੰਦਾ ਉਸ ਤਰ੍ਹਾਂ ਦਾ ਹੀ ਆਪਾਂ ਬੈਡ ਤਿਆਰ ਕਰ ਦਿੰਦੇ ਹਾਂ ਹਾਂਜੀ ਹਾਂਜੀ ਲੱਕੜ ਵਿੱਚ ਡਿਜ਼ਾਈਨ ਆ ਹਾਂਜੀ ਠੀਕ ਹੈ ਹਾਂਜੀ ਚਲੋ ਜਿੱਦਾਂ ਤੁਹਾਨੂੰ ਠੀਕ ਲੱਗਦੇ ਤਿੰਨ ਫੁੱਟ ਜਿੰਨਾ ਵੀ ਕਹੋਗੇ ਤੁਸੀਂ ਹਾਂਜੀ ਲੱਕੜ ਦੇਖ ਲਿਓ ਤੁਸੀਂ ਦਿਓਗੇ ਜਾਂ ਆਪਣੇ ਵੱਲੋਂ ਅਸੀਂ ਲਾਈਏ ਟਾਹਲੀ ਦੀ ਹੋ ਗਈ ਇਹਦੀ ਕਿੱਕਰ ਦੀ ਹੋ ਗਈ ਜਿਹੜੀ ਤੁਸੀਂ ਕਹੋਗੇ ਉਹ ਹੀ ਵੈਸੇ ਤਾਂ ਟਾਹਲੀ ਦਾ ਵਧੀਆ ਹੁੰਦਾ ਆ ਹਾਂਜੀ ਇਹ ਤਾਂ ਹੈ ਚਲੋ ਜਿਵੇਂ ਤੁਸੀਂ ਹਾਂਜੀ ਲੱਕੜ ਦਾ ਹਾਂਜੀ ਲੱਕੜ ਦਾ ਤੁਹਾਨੂੰ ਦੱਸ ਦਿਆਂਗੇ ਕਿਹਦੀ ਵਧੀਆ ਬਣੇਗੀ ਹਾਂਜੀ ਟੇਬਲ ਵਗੈਰਾ ਵੀ ਦਿੰਦੇ ਹਾਂ ਉਹਦੀ ਮਤਲਬ ਕਿ ਹਾਂਜੀ ਢੋਅ ਵਗੈਰਾ ਨਾਲ ਜੋ ਵੀ ਦੱਸੋਗੇ ਟੇਬਲ ਵੀ ਬਣਨਗੇ ਨਾਲ ਬਕਸੇ ਵੀ ਬਣਨਗੇ ਹਾਂਜੀ ਹਾਂਜੀ ਬੈਡ ਦੇ ਨਾਲ ਛੋਟਾ ਟੇਬਲ ਸਮਝ ਗਏ ਜੀ ਹਾਂਜੀ ਅੱਗੇ ਹੁੰਦਾ ਵੱਡਾ ਟੇਬਲ ਜੀ ਉਹ ਤਾਂ ਸੈਟ ਹੈ ਜੇ ਤੁਸੀਂ ਕਹੋਗੇ ਤਾਂ ਸੈਟ ਬਣਾ ਦਿਆਂਗੇ ਹਾਂਜੀ ਪੂਰਾ ਫਰਨੀਚਰ ਠੀਕ ਹੈ ਜੀ ਸੈਟ ਬਣ ਜਾਊਗਾ ਜੀ ਜੇ ਸੈੱਟ ਬਣਵਾਓਗੇ ਫਿਰ ਤਾਂ ਚਾਲ੍ਹੀ ਪੰਜਾਹ ਹਜ਼ਾਰ ਆ ਹੀ ਜਾਣਾ ਹੈ ਇਕੱਲੇ ਬੈਡ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਵੀਹ ਪੱਚੀ ਹਜ਼ਾਰ ਦੇ ਤੀਹ ਹਜ਼ਾਰ ਤੱਕ ਤਾਂ ਵਧੀਆ ਡਿਜ਼ਾਇਨ ਪਾ ਕੇ ਵਧੀਆ ਬੈਡ ਹੀ ਤਿਆਰ ਹੁੰਦਾ ਆ ਅਤੇ ਹਾਂਜੀ ਹਾਂਜੀ ਤਸੱਲੀ ਨਹੀਂ ਹੁੰਦੀ ਜੀ ਲੱਕੜ ਦੀ ਕੋਈ ਹਾਂਜੀ ਨਹੀਂ ਨਹੀਂ ਇਹ ਫਿਰ ਆਪਣੀ ਬਣਵਾਈ ਵਿੱਚ ਹੀ ਆ ਜਾਣੀ ਨਹੀਂ ਨਹੀਂ ਬੰਦੇ ਤਾਂ ਵੇਖੋ ਜੀ ਚਾਹੀਦੇ ਆ ਕਾਰੀਗਰੀ ਵਾਲਾ ਕੰਮ ਹੈ ਸੈਟ ਹੈ ਪੂਰਾ ਉਹ ਤਾਂ ਫਿਰ ਬੰਦੇ ਆਪਣੇ ਹੀ ਹੋਣਗੇ ਤੁਹਾਨੂੰ ਕੋਈ ਟੈਂਸ਼ਨ ਨਹੀਂ ਤੁਸੀਂ ਮਤਲਬ ਕੀ ਵਾ ਹਾਂਜੀ ਉਹ ਵਿੱਚ ਵਿੱਚ ਐਡ ਹੋ ਜਾਣਗੇ ਤੁਹਾਡੇ ਵਿੱਚੇ ਐਡ ਹੋ ਜਾਣਗੇ ਅਤੇ ਬਾਕੀ ਤੁਸੀਂ ਵੇਖ ਲਿਓ ਸੈਟ ਬਣਾਓਗੇ ਚਾਲ੍ਹੀ ਪੰਜਾਹ ਹਜ਼ਾਰ ਤੱਕ ਆ ਜਾਊਗਾ ਖਰਚਾ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਕੋਈ ਨਹੀਂ ਜਿਵੇਂ ਤੁਹਾਨੂੰ ਠੀਕ ਲੱਗ ਜਾਵੇ ਕੋਲ ਕਰੋਗੇ ਉਦੋਂ ਹੀ ਆ ਜਾਵਾਂਗੇ ਹਾਂਜੀ ਠੀਕ ਹੈ ਜੀ ਜਦੋਂ ਮਰਜੀ ਬੁਲਾ ਲਿਓ ਓਕੇ ਚਲੋ ਓਕੇ